ਭਾਰਤ ਦੀ ਸਿੱਖਿਆ ਪ੍ਰਣਾਲੀ ਬਹੁਤ ਹੀ ਵਧੀਆ ਹੈ ਕਿਉਂਕਿ ਇਹ ਸਾਨੂੰ ਵਧੀਆ ਵਧੀਆ ਮੌਕੇ ਪ੍ਰਦਾਨ ਕਰਦੀ ਹੈ ਅਤੇ ਸਾਨੂੰ ਜੀਵਨ ਦੇ ਪੱਧਰ ਨੂੰ ਉੱਚਾ ਚੁੱਕਣ ਵਿੱਚ ਵੀ ਸਾਡੀ ਸਹਾਇਤਾ ਕਰਦੀ ਹੈ ਕਿਉਂਕਿ ਸਿੱਖਿਆ ਨਾਲ ਹੀ ਕੋਈ ਬੰਦਾ ਅਮੀਰ ਹੋ ਸਕਦਾ ਹੈ ਅਤੇ ਉਸ ਵਿੱਚ ਉਸਨੂੰ ਉਨੀ ਹੀ ਜ਼ਿਆਦਾ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਆ ਸਿੱਖਿਆ ਦੀ ਪ੍ਰਾਪਤੀ ਨਾਲ ਸਭ ਭਾਰਤ ਵਿੱਚ ਇਹ ਪਾਇਆ ਜਾਂਦਾ ਹੈ ਕਿ ਬੱਚਾ ਅੱਠਵੀਂ ਜਮਾਤ ਤੱਕ ਤਾਂ ਜ਼ਰੂਰ ਪੜ੍ਹਨਾ ਚਾਹੀਦਾ ਹੈ ਭਾਰਤ ਵਿੱਚ ਸਰਕਾਰੀ ਸਕੂਲ ਪ੍ਰਾਈਵੇਟ ਅਤੇ ਨੋਨ ਪ੍ਰਾਈਵੇਟ ਸਕੂਲਜ਼ ਵੀ ਪਾਏ ਜਾਂਦੇ ਹਨ ਇਸ ਵਿੱਚ ਕੀ ਹੈ ਕਿ ਇਸ ਵਿੱਚ ਸਾਰੇ ਹੀ ਵਧੀਆ ਸਕੂਲ ਨੇ ਪਰ ਸਾਰੇ ਲੋਕ ਜ਼ਿਆਦਾ ਸਰਕਾਰੀ ਸਕੂਲਾਂ ਨਾਲੋਂ ਜ਼ਿਆਦਾ ਪ੍ਰਾਈਵੇਟ ਵਿੱਚ ਪੜ੍ਹਨਾ ਪਸੰਦ ਕਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਪ ਪ੍ਰਾਈਵੇਟ ਵਿੱਚ ਪੜ੍ਹਨ ਨਾਲ ਉਹਨਾਂ ਦਾ ਬੱਚਾ ਜ਼ਿਆਦਾ ਹੀ ਅੰਗਰੇਜ਼ੀ ਬੋਲਣ ਵਿੱਚ ਵਧੀਆ ਹੋ ਜਾਵੇਗਾ ਪਰ ਇਹ ਚੀਜ਼ ਬਿਲਕੁਲ ਹੀ ਗਲਤ ਹੈ ਕਿਉਂਕਿ ਸਰਕਾਰੀ ਸਕੂਲ ਵੀ ਉਨੀ ਹੀ ਮਾਨਤਾ ਰੱਖਦੇ ਨੇਗੇ ਉਹ ਵੀ ਉਨਾਂ ਹੀ ਚੀਜ਼ ਸਾਨੂੰ ਪ੍ਰੋਵਾਈਡ ਕਰਦੇ ਨੇਗੇ ਉਹ ਸਾਨੂੰ ਕਾਫੀ ਮੌਕੇ ਵੀ ਪ੍ਰਦਾਨ ਕਰਦੇ ਨੇ ਜਿਨ੍ਹਾਂ ਨਾਲ ਕਿ ਕੋਈ ਗਰੀਬ ਦਾ ਬੱਚਾ ਵੀ ਪੜ੍ਹ ਸਕਦਾ ਹੈ ਸਕੂਲ ਵਿੱਚ ਕਿਉਂਕਿ ਹੁਣ ਬ ਭਾਰਤ ਦੇ ਵਿੱਚ ਬੱਚਿਆਂ ਦਾ ਸ਼ੋਸ਼ਣ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਕਰਕੇ ਉਹ ਚਾਹੁੰਦੇ ਨੇ ਕਿ ਸਾਰੇ ਬੱਚੇ ਅੱਠਵੀਂ ਤੱਕ ਤਾਂ ਜ਼ਰੂਰ ਹੀ ਪੜ੍ਹਨ ਇਹ ਦੂਜੇ ਦੇ ਦੂਜੇ ਦੇਸ਼ਾਂ ਨਾਲੋਂ ਵੀ ਇਹ ਵੱਖ ਹੈ ਕਿਉਂਕਿ ਇਸ ਵਿੱਚ ਕਾਫੀ ਸਾਰੀਆਂ ਤੁਲਨਾਵਾਂ ਪਾਈਆਂ ਜਾਂਦੀਆਂ ਹਨ ਇਸ ਵਿੱਚ ਕਾਫੀ ਵੀ ਕਮੀਆਂ ਵੀ ਨੇ ਅਤੇ ਇਹਨਾਂ ਵਿੱਚ ਅਸੀਂ ਸੁਧਾਰ ਵੀ ਕਰ ਸਕਦੇ ਹਾਂ ਸੁਧਾਰ ਅਸੀਂ ਕਿਵੇਂ ਕਰ ਸਕਦੇ ਹਾਂ ਕਿ ਉਹਨਾਂ ਨੂੰ ਕਾਫੀ ਮੌਕੇ ਪ੍ਰਦਾਨ ਕਰਨੇ ਚਾਹੀਦੇ ਨੇਗੇ ਉਹਨਾਂ ਨੂੰ ਕਾਫੀ ਸਕੋਲਰਸ਼ਿਪਸ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਜਿਹੜਾ ਕੋਈ ਗਰੀਬ ਬੱਚਾ ਹੈ ਉਹ ਵੀ ਪੜ੍ਹ ਲਿਖ ਕੇ ਵਧੀਆ ਅਫਸਰ ਵੀ ਬਣ ਸਕਦਾ ਹੈ